ਹੈਲੋ ਹਾਂਜੀ ਮੈਮ ਹਾਂਜੀ ਯੂਨੀਵਰਸਿਟੀ ਤੋਂ ਗੱਲ ਕਰ ਰਹੇ ਹਾਂ ਹਾਂਜੀ ਮੈਮ ਹਾਂਜੀ ਮੈਮ ਹਾਂਜੀ ਹਾਂਜੀ ਹਾਂਜੀ ਅਤੇ ਮੈਮ ਤੁਹਾਨੂੰ ਕੀ ਦਿੱਕਤ ਆ ਰਹੀ ਹੈ ਕਲਾਸਰੂਮ ਦੇ ਅਕੋਰਡਿੰਗ ਮਤਲਬ ਕਲਾਸਿਸ ਲੈਕਚਰਾਰ ਵਗੈਰਾ ਲੈਕਚਰ ਸਹੀ ਨਹੀਂ ਲੱਗ ਰਹੇ ਮਤਲਬ ਤੁਹਾਨੂੰ ਪੀਰੀਅਡ ਵਿੱਚ ਥੋੜ੍ਹਾ ਜਿਹਾ ਦਿੱਕਤ ਆ ਰਹੀ ਹੈ ਜਾਂ ਘੱਟ ਟਾਈਮ ਹੈ ਕੀ ਦਿੱਕਤ ਆ ਰਹੀ ਹੈ ਤਹਾਨੂੰ ਤੁਸੀਂ ਦੱਸੋ ਹਾਂਜੀ ਹਾਂਜੀ ਯੂ ਯੂ ਮੀਨ ਮਤਲਬ ਤੁਹਾਡਾ ਮਤਲਬ ਇਹ ਹੈ ਕਿ ਲੈਕਚਰ ਦਾ ਟਾਈਮ ਤੁਹਾਡਾ ਘੱਟ ਚੱਲ ਰਿਹਾ ਹਾਂਜੀ ਤਾਂ ਦੇਖੋ ਅਸੀਂ ਮਤਲਬ ਯੂਨੀਵਰਸਿਟੀ ਦੇ ਅਕੋਰਡਿੰਗ ਹੀ ਤੁਹਾਡਾ ਸ਼ਡਿਊਲ ਵਗੈਰਾ ਬਣਾ ਸਕਦੇ ਹਾਂ ਉਸਦੇ ਹਿਸਾਬ ਨਾਲ ਹੀ ਅਸੀਂ ਤੁਹਾਡਾ ਸਾਰਾ ਕੁਛ ਚੇਂਜ ਕਰ ਸਕਦੇ ਹਾਂ ਜਿੱਦਾਂ ਯੂਨੀਵਰਸਿਟੀ ਦੇ ਰੂਲਸ ਹੋਣਗੇ ਉਸ ਹਿਸਾਬ ਨਾਲ ਅਸੀਂ ਤੁਹਾਡਾ ਜਿੰਨਾ ਹੋਇਆ ਹੈ ਨਾ ਅਸੀਂ ਸਾਰਾ ਸੈੱਟ ਕਰਕੇ ਤੁਹਾਨੂੰ ਭੇਜ ਦਾਂਗੇ ਹਾਂਜੀ ਅਤੇ ਹਾਂਜੀ ਠੀਕ ਹੈ ਉਹ ਤਾਂ ਮੈਂ ਦੇਖ ਲੈਂਦੀ ਹਾਂ ਪਰ ਜਿੱਦਾਂ ਵੀ ਸਾਨੂੰ ਯੂਨੀਵਰਸਿਟੀ ਅਲੋਅ ਕਰੇਗੀ ਕਿ ਵੀ ਇੱਦਾਂ ਹੈ ਨਾ ਤੁਹਾਡਾ ਸ਼ਡਿਊਲ ਸੈੱਟ ਕਰਨਾ ਫਿਰ ਉਸ ਹਿਸਾਬ ਨਾਲ ਤੁਹਾਨੂੰ ਸ਼ੈਡਿਊਲ ਬਣਾ ਕੇ ਭੇਜ ਦਾਂਗੇ ਪ੍ਰੋਪਰ ਤੁਹਾਨੂੰ ਫੋਲੋ ਤੁਸੀਂ ਕਰ ਲੈਣਾ ਉਸ ਹਿਸਾਬ 'ਤੇ ਤੁਸੀਂ ਤੁਸੀਂ ਸਾਨੂੰ ਭੇਜ ਦਿਉ ਆਪਣਾ ਜਿਹੜਾ ਤੁਹਾਡਾ ਉਹ ਹੋ ਸਕਦਾ ਮਤਲਬ ਤੁਸੀਂ ਚਾਹੁੰਦੇ ਹੋ ਕਿ ਸਾਡਾ ਸ਼ਡਿਊਲ ਇਹ ਹੋਏ ਮਤਲਬ ਇੰਨੇ ਮਿੰਟ ਦਾ ਹੋਏ ਸਾਡੀ ਕਲਾਸਿਜ ਇੰਨੀਆਂ ਮਿੰਟ ਦੀਆਂ ਅਸੀਂ ਲਗਾ ਸਕੀਏ ਸਟੂਡੈਂਟਸ ਨੂੰ ਅੱਛਾ ਪੜ੍ਹਾ ਸਕੀਏ ਉਸ ਹਿਸਾਬ ਨਾਲ ਤੁਸੀਂ ਆਪਣਾ ਮੈਨੂੰ ਸ਼ਡਿਊਲ ਸੈਂਡ ਕਰ ਦੇਣਾ ਅਤੇ ਉਸ ਤੋਂ ਬਾਅਦ ਤੁਸੀਂ ਲੈਕਚਰ ਵਿੱਚ ਤੁਸੀਂ ਜਿੰਨੇ ਸਬਜੈਕਟ ਤੁਹਾਡੇ ਹੁੰਦੇ ਹੈ ਉਸ ਹਿਸਾਬ ਨਾਲ ਤੁਸੀਂ ਮੈਨੂੰ ਉਹ ਭੇਜ ਦੇਣਾ ਅਤੇ ਅਸੀਂ ਉਸ ਹਿਸਾਬ ਨਾਲ ਤੁਹਾਨੂੰ ਤੁਹਾਡਾ ਸ਼ਡਿਊਲ ਸੈੱਟ ਕਰਕੇ ਤੁਹਾਨੂੰ ਦੱਸ ਦਾਂਗੇ ਅਤੇ ਅਸੀਂ ਅਪਲਾਈ ਕਰ ਦਾਂਗੇ ਤੁਹਾਡੀ ਰਿਕੁਐਸਟ ਹਾਂਜੀ ਤੁਸੀਂ ਭੇਜ ਦੇਣਾ ਕੀ ਕੀ ਹੈਗਾ ਫਿਰ ਉਸ ਹਿਸਾਬ ਨਾਲ ਅਸੀਂ ਤੁਹਾਨੂੰ ਸਲੇਬਸ ਵਗੈਰਾ ਬਣਾ ਕੇ ਅਤੇ ਸ਼ੈਡਿਊਲ ਸੈੱਟ ਕਰਕੇ ਅਤੇ ਤੁਹਾਨੂੰ ਭੇਜ ਦਾਂਗੇ ਅਤੇ ਤੁਸੀਂ ਫਿਰ ਆਪਣਾ ਕੰਟੀਨਿਊ ਸਟੂਡੈਂਟਸ ਲਈ ਜੋ ਕਰਨਾ ਉਹ ਕਰ ਸਕਦੇ ਹੋ ਜਿੰਨਾ ਹੋਇਆ ਅਸੀਂ ਉਹਦੇ ਵਿੱਚ ਕਰਕੇ ਦੇਖਾਂਗੇ ਯੂਨੀਵਰਸਿਟੀ ਦੇ ਹਿਸਾਬ ਨਾਲ ਹੀ ਅਸੀਂ ਕਰ ਸਕਦੇ ਹਾਂ ਜੋ ਕਰਾਂਗੇ ਬਾਕੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਕੋਈ ਦਿੱਕਤ ਨਾ ਆਏ ਹਾਂਜੀ ਹਾਂਜੀ ਉਹ ਤਾਂ ਦੇਖੋ ਤੁਸੀਂ ਬੱਚਿਆਂ ਨੂੰ ਤੁਸੀਂ ਇਹ ਤਾਂ ਤੁਹਾਡੇ ਕੋਲਜ ਦੇ ਹਿਸਾਬ ਨਾਲ ਹੈ ਅਗਰ ਤੁਸੀਂ ਕੋਲਜ ਦੀ ਟਾਈਮਿੰਗ ਜਾਂ ਉੱਥੋਂ ਦੇ ਰੂਲਸ ਰੈਗੂਲੇਸ਼ਨਸ ਨੂੰ ਅਗਰ ਬੱਚੇ ਫੋਲੋ ਨਹੀਂ ਕਰਦੇ ਤਾਂ ਤੁਹਾਡੇ ਵੀ ਤੁਹਾਨੂੰ ਸਟਰਿਕਨੈਸ ਕਰਨ ਦੀ ਲੋੜ ਹੈ ਬਾਕੀ ਸ਼ੈਡਿਊਲ ਵਗੈਰਾ ਹੋ ਗਿਆ ਜਾਂ ਸਲੇਬਸ ਦੇ ਰਿਗਾਰਡਿੰਗ ਕੁਛ ਵੀ ਹੈ ਤਾਂ ਉਹ ਅਸੀਂ ਕਰਾਂਗੇ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਓਕੇ